ਤੁਹਾਡੇ ਹਿਸਾਬ ਦੇ ਨਾਲ ਮੋਬਾਇਲ ਫੋਨ ਦੇ ਫਾਇਦੇ ਅਤੇ ਨੁਕਸਾਨ ਕੀ ਹਨ ਮੇਰੇ ਹਿਸਾਬ ਦੇ ਨਾਲ ਮੋਬਾਇਲ ਫੋਨ ਦੇ ਵੱਖ ਵੱਖ ਫਾਇਦੇ ਹਨ ਜਿਵੇਂ ਕਿ ਮੋਬਾਇਲਸ ਫੋਨ ਦੀ ਮਦਦ ਦੇ ਨਾਲ ਅਸੀਂ ਕੁਛ ਵੀ ਜਾਣਨਾ ਹੋਵੇ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਿਚਾਰ ਕਿਸੇ ਨਾਲ ਸਾਂਝਾ ਕਰਨਾ ਹੋਵੇ ਤਾਂ ਅਸੀਂ ਕੋਲ ਦੇ ਦੁਆਰਾ ਸਾਂਝਾ ਕਰ ਸਕਦੇ ਹਾਂ ਅਤੇ ਜੇ ਕੋਈ ਸ਼ਬਦ ਜਾਂ ਫਿਰ ਵਿਆਕਰਨ ਦੀ ਸਾਨੂੰ ਸਮਝ ਨਹੀਂ ਲੱਗਦੀ ਤਾਂ ਉਸ ਚੀਜ਼ ਨੂੰ ਅਸੀਂ ਇੰਟਰਨੈੱਟ ਦੀ ਮਦਦ ਦੇ ਨਾਲ ਖੋਜ ਸਕਦੇ ਹਾਂ ਅਤੇ ਉਸ ਬਾਰੇ ਜਾਂਚ ਕਰ ਸਕਦੇ ਹਾਂ ਮੋਬਾਇਲ ਫੋਨ ਸਾਡੇ ਮਨੋਰੰਜਨ ਦਾ ਵੀ ਸਾਧਨ ਬਣਦਾ ਹੈ ਇਸ ਦੇ ਵੱਖ ਵੱਖ ਐਪਲੀਕੇਸ਼ਨਾਂ ਦੇ ਰਾਹੀਂ ਸਾਡਾ ਮਨੋਰੰਜਨ ਹੁੰਦਾ ਹੈ ਮੋਬਾਇਲ ਫੋਨ ਦੇ ਰਾਹੀਂ ਅਸੀਂ ਆਪਣੀ ਯਾਦਾਂ ਯਾਦਾਂ ਕੈਦ ਕਰ ਸਕਦੇ ਹਾਂ ਜਿਨ੍ਹਾਂ ਨੂੰ ਕਿ ਅਸੀਂ ਫੋਟੋ ਅਤੇ ਵੀਡੀਓ ਦੇ ਰੂਪ ਵਿੱਚ ਵੀ ਕੈਦ ਕਰ ਸਕਦੇ ਹਾਂ ਮੋਬਾਇਲ ਫੋਨ ਦੇ ਰਾਹੀਂ ਕੈਲਕੁਲੇਸ਼ਨ ਹਿਸਾਬ ਕਿਤਾਬ ਵੀ ਕਰ ਸਕਦੇ ਹਾਂ ਅਤੇ ਮੋਬਾਇਲ ਫੋਨ ਦੇ ਨਾਲ ਅਸੀਂ ਸੰਗੀਤ ਵੀ ਸੁਣ ਸਕਦੇ ਹਾਂ ਮ ਜਿੱਥੇ ਮੋਬਾਇਲ ਦੇ ਫਾਇਦੇ ਹਨ ਤਾਂ ਉੱਥੇ ਇਸ ਦੇ ਕੁਝ ਕੁ ਨੁਕਸਾਨ ਵੀ ਹਨ ਮੋਬਾਇਲ ਫੋਨ ਦੇ ਵਿੱਚੋਂ ਨਿਕਲਦੀਆਂ ਰੇਡੀਏਸ਼ਨਸ ਸਾਡੀ ਅੱਖਾਂ ਲਈ ਖ਼ਰਾਬ ਹੁੰਦੀਆਂ ਹਨ ਮੋਬਾਇਲ ਫੋਨ ਕਈ ਵਾਰ ਫਟਣ ਜਾਂ ਉਨ੍ਹਾਂ ਦੀ ਹੀਟਿੰਗ ਕਾਰਨ ਵੀ ਬਹੁਤ ਸਾਰੇ ਨੁਕਸਾਨ ਹੁੰਦੇ ਹਨ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਅਸੀਂ ਆਪਣੇ ਸਾਥੀ ਅਤੇ ਘਰ ਪਰਿਵਾਰ ਨੂੰ ਵੇਲਾ ਦੇਣ ਵਿੱਚ ਘਾਟ ਹੋ ਜਾਂਦੀ ਹੈ ਅਤੇ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਦੇ ਨਾਲ ਅੱਖਾਂ 'ਤੇ ਵੀ ਮਾੜਾ ਅਸਰ ਪੈਂਦਾ ਹੈ